ਸਤਿ ਸ਼੍ਰੀ ਅਕਾਲ ਮੈਂ ਕਮਲ ਗੱਲ ਕਰ ਰਹੀ ਹਾਂ ਕੀ ਤੁਸੀਂ ਪਰਦੇਸੀ ਢਾਬੇ ਦੇ ਮੈਨੇਜਰ ਗੱਲ ਕਰ ਰਹੇ ਹੋ ਮੈਂ ਗਲਤ ਔਡਰ ਬਾਰੇ ਸ਼ਿਕਾਇਤ ਕਰਨੀ ਸੀ ਐਕਚੁਲੀ ਮੈਂ ਕੁਛ ਟਾਈਮ ਪਹਿਲਾਂ ਕੁਝ ਔਡਰ ਕੀਤਾ ਸੀ ਜਿਵੇਂ ਕਿ ਦਾਲ ਮੱਖਣੀ ਜ਼ੀਰਾ ਰਾਈਸ ਕੜਾਈ ਪਨੀਰ ਮਿਕਸ ਰਾਇਤਾ ਪੰਜ ਆਲੂ ਦੇ ਪਰੌਂਠੇ ਛੋਲੇ ਭਟੂਰੇ ਕਿਉਂਕਿ ਮੇਰਾ ਔਡਰ ਮੇਰੇ ਤੱਕ ਨਹੀਂ ਪਹੁੰਚਿਆ ਤੁਹਾਡਾ ਡਿਲੀਵਰੀ ਬੋਆਏ ਔਡਰ ਦੇ ਕੇ ਤਾਂ ਗਿਆ ਜੋ ਔਡਰ ਮੈਂ ਨਹੀਂ ਕੀਤਾ ਸੀ ਉਹ ਵਾਲਾ ਮੈਂ ਅੰਦਰ ਆ ਕੇ ਖੋਲ੍ਹ ਕੇ ਵੇਖਿਆ ਆ ਪਰ ਉਸ ਉਹ ਉਸ ਵਿੱਚ ਚਾਈਨੀਜ਼ ਅਤੇ ਨੋਨ ਵੈਜ ਆਈਟਮਸ ਹਨ ਜੋ ਕਿ ਮੈਂ ਔਡਰ ਨਹੀਂ ਕੀਤੀਆਂ ਜਾਂ ਤਾਂ ਫਿਰ ਮੇਰਾ ਔਡਰ ਕੈਂਸਲ ਕੀਤਾ ਜਾਵੇ ਅਤੇ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਵੇ ਜਾਂ ਫਿਰ ਤੁਸੀਂ ਆਪਣੇ ਡਿਲੀਵਰੀ ਬੋਆਏ ਨਾਲ਼ ਕੋਂਟੈਕਟ ਕਰੋ ਅਤੇ ਉਹ ਮੈਨੂੰ ਮੇਰਾ ਔਡਰ ਦੇ ਕੇ ਜਾਵੇ ਅਤੇ ਇਹ ਔਡਰ ਲੈ ਕੇ ਜਾਵੇ